ਜਦੋਂ ਕਿ ਅਸੀਂ ਵੱਖ ਵੱਖ ਵਿਸ਼ੇ ਪੜ੍ਹ ਸਕਦੇ ਹਾਂ ਬਟ ਜੇ ਅਸੀਂ ਤਕਨੋਲਜੀ ਦੇ ਮਾਮਲੇ ਦੇ ਵਿੱਚ ਵੇਖਿਆ ਜਾਵੇ ਤਾਂ ਇਹਦੀ ਅਰਜੀ ਲੇਅਰਿੰਗ ਬਾਰੇ ਦੇਖਿਆ ਜਾਵੇ ਤਾਂ ਜਿੱਦਾਂ ਕਿ ਇਲੈਕਟਰੀਕਲ ਹੋ ਗਿਆ ਟੈਕਨੀਸ਼ਨ ਹੋ ਗਿਆ ਅਤੇ ਇੱਦਾਂ ਕਰਕੇ ਮਤਲਬ ਅਸੀਂ ਸਾਰੇ ਵਿਸ਼ਿਆਂ ਦੇ ਵਿੱਚ ਨਹੀਂ ਪ੍ਰੀਪੇਅਰ ਹੋ ਸਕਦੇ ਇਹਦੇ ਵਿੱਚ ਅਸੀਂ ਕੋਈ ਇੱਕ ਵਿਸ਼ਾ ਹੀ ਰੀਡ ਕਰ ਸਕਦੇ ਹਾਂ ਜ਼ਰੂਰੀ ਨਹੀਂ ਹੈਗਾ ਕਿ ਇਹਦੇ ਵਿੱਚ ਅਸੀਂ ਸਾਰੇ ਵਿਸ਼ਿਆਂ ਨਾਲ ਹੀ ਮਤਲਬ ਆਪਣੇ 'ਤੇ ਸਟਰੈਸ ਲੈਣਾ ਇਹਦੇ ਵਿੱਚ ਸਿਰਫ ਇੱਕ ਵਿਸ਼ੇ ਦੀ ਲੇਅਰਿੰਗ ਹੋ ਸਕਦੀ ਆ ਇੱਦਾਂ ਨਹੀਂ ਹੈ ਸਕਦਾ ਕਿ ਅਸੀਂ ਇਲੈਟਰੇਸ਼ਨ ਵੀ ਕਰ ਲਿਆ ਮਕੈਨਿਕਲ ਦਾ ਕੋਰਸ ਵੀ ਕਰ ਲਿਆ ਕਿਉਂਕਿ ਇਹਨਾਂ ਦਾ ਕਰਨਾ ਇਹਨਾਂ ਦੀ ਸਟਡੀ ਵੀ ਅਲੱਗ ਅਲੱਗ ਹੁੰਦੀ ਹੈ ਇਹਨਾਂ ਦੀ ਸਟਡੀ ਕਰਨੀ ਇਹਨਾਂ ਦੇ ਐਗਜਾਮ ਦੇਣੇ ਸਾਰਾ ਕੁਛ ਹੀ ਅਲੱਗ ਅਲੱਗ ਵਿਸ਼ੇ 'ਚ ਆ ਜਾਂਦਾ ਅਲੱਗ ਅਲੱਗ ਮੈਥਡ ਹੁੰਦੇ ਨੇ ਸਾਰਿਆਂ ਦੇ ਜਿਹਨਾਂ ਨੂੰ ਕਿ ਅਸੀਂ ਪੜ੍ਹਨਾ ਸਾਡੇ ਲਈ ਬਹੁਤ ਮੁਸ਼ਕਲ ਹੋ ਸਕਦਾ ਕਿਉਂਕਿ ਮੋਸਟਲੀ ਇਹਨਾਂ ਦਾ ਤਾਂ ਸਿਰਫ ਇੱਕ ਹੀ ਵਿਸ਼ਾ ਅਸੀਂ ਚੰਗੀ ਤਰ੍ਹਾਂ ਜੇ ਪੜ੍ਹ ਸਕਦੇ ਹਾਂ ਉਹਦਾ ਇਗਜ਼ਾਮ ਦੇ ਸਕਦੇ ਹਾਂ ਤਾਂ ਉਹਦੀ ਇੱਕ ਤਰ੍ਹਾਂ ਨਾਲ ਪ੍ਰੋਪਰ ਲੇਅਰਿੰਗ ਹੋ ਜਾਂਦੀ ਆ ਤਾਂ ਜੋ ਕਿ ਸਾਨੂੰ ਸਮਝ ਵੀ ਆ ਜਾਂਦਾ ਅਤੇ ਪ੍ਰੋਪਰ ਸਾਡੇ ਅ ਸਾਡੇ ਕਨਫਰਮ ਵੀ ਹੋ ਜਾਂਦਾ ਵੀ ਕਿਹੜੀ ਚੀਜ਼ ਕਿੱਦਾਂ ਹੋਏਗੀ ਜੇਕਰ ਅਸੀਂ ਇਲੈਕਟਰੋਨਿਕ ਦਾ ਕੋਰਸ ਕਰਦੇ ਹਾਂ ਤਾਂ ਉਹਦੇ ਵਿੱਚ ਜਿੱਦਾਂ ਇਲੈਕਟਰੀਕਲਸ ਸਾਰੇ ਸ ਸਾਧਨ ਹੁੰਦੇ ਨੇ ਤਾਂ ਸਾਨੂੰ ਉਹਨਾਂ ਬਾਰੇ ਨੌਲੇਜ ਹੋ ਜਾਂਦੀ ਹੈ ਵੀ ਉਹ ਅਸੀਂ ਕਿੱਦਾਂ ਕਿੱਦਾਂ ਕਰਕੇ ਅਗਰ ਜੇ ਉਹ ਇਲੈਕਟਰੋਨਿਕ ਸਾਧਨ ਸ ਖ਼ਰਾਬ ਵੀ ਹੁੰਦੇ ਨੇ ਤਾਂ ਆਪਾਂ ਉਹਦੀ ਕਿੱਦਾਂ ਕਿੱਦਾਂ ਕਰਕੇ ਪ੍ਰਪੇਅਰ ਉਹਨਾਂ ਨੂੰ ਰਿਪੇਅਰ ਕਰ ਸਕਦੇ ਹਾਂ ਇਹਦੇ ਵਿੱਚ ਸਾਰਾ ਕੁਛ ਜੇ ਅਸੀਂ ਇੱਕ ਸਬਜੈਕਟ ਬਾਰੇ ਚੰਗੀ ਤਰ੍ਹਾਂ ਨੌਲੇਜ ਲੈ ਸਕਦੇ ਹਾਂ ਤਾਂ ਇਹ ਸਿਰਫ ਇੱਕ ਸਬਜੈਕਟ ਦੀ ਲੇਅਰਿੰਗ ਹੋਏਗੀ ਵੱਖ ਵੱਖ ਸਬਜੈਕਟਸ ਨਾਲ ਤਾਂ ਅਸੀਂ ਕੰਫਿਊਜ ਹੋ ਸਕਦੇ ਜਿਸ ਕਰਕੇ ਵੀ ਅਸੀਂ ਇੰਨੇ ਵਿਸ਼ੇ ਨਹੀਂ ਪੜ੍ਹ ਸਕਦੇ ਤਾਂ ਇਹ ਤਕਨੋਲਜੀ ਬਾਰੇ ਤਾਂ ਸਿਰਫ ਅਸੀਂ ਇਹ ਹੀ ਚੀਜ਼ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਸਿਰਫ ਵਿਸ਼ਾ ਹੋਵੇ ਤਾਂ ਇੱਕ ਹੀ ਚੁਣਿਆ ਜਾਵੇ ਤਾਂ ਜੋ ਕਿ ਅਸੀਂ ਉਹਦੇ ਬਾਰੇ ਵਧੀਆ ਗਿਆਨ ਲੈ ਸਕਦੇ ਹਾਂ